ਜੇਕਰ ਕੁਦਰਤੀ ਆਫ਼ਤਾਂ ਦੀ ਗੱਲ ਕੀਤੀ ਜਾਵੇ ਤਾਂ ਕੁਛ ਸਮੇਂ ਪਹਿਲਾਂ ਹੀ ਬਹੁਤ ਜ਼ਿਆਦਾ ਬਾਰਿਸ਼ ਹੋਣ ਕਰਕੇ ਫਸਲਾਂ ਜੋ ਵੀ ਫਸਲਾਂ ਸੀ ਉਹ ਉਨ੍ਹਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਹੈ ਅਤੇ ਇਸੇ ਤਰ੍ਹਾਂ ਹੀ ਸੜਕਾਂ ਦਾ ਟੁੱਟਣਾ ਪੁਲਾਂ ਦਾ ਟੁੱਟਣਾ ਘਰਾਂ ਦਾ ਗਿਰਨਾ ਅਤੇ ਇੱਦਾਂ ਹੀ ਬਹੁਤ ਸਾਰੀ ਦੁਕਾਨ ਦੁਕਾਨਦਾਰਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਇਸ ਨਾਲ਼ ਹੀ ਬਹੁਤ ਸਾਰੀ ਬਿਮਾਰੀਆਂ ਫੈਲ ਗਈਆਂ ਹਨ ਜੋ ਕਿ ਹਾਲੇ ਤੱਕ ਕੰਟਰੋਲ ਵਿੱਚ ਨਹੀਂ ਹਨ ਮੈਂ ਸਰਕਾਰ ਨੂੰ ਬਸ ਐਨੀ ਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਜੋ ਵੀ ਇਹਨਾਂ ਦਾ ਨੁਕਸਾਨ ਹੋਇਆ ਹੈ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਜਿਨ੍ਹਾਂ ਕੋਲ ਰਹਿਣ ਲਈ ਅਤੇ ਖਾਣ ਪੀਣ ਲਈ ਟਿਕਾਣੇ ਅਤੇ ਜਗ੍ਹਾ ਨਹੀਂ ਹਨ ਉਹਨਾਂ ਨੂੰ ਇਹ ਸਭ ਦਿੱਤੀਆਂ ਜਾਣ